ਮੈਂ ਬਹੁਤ ਸਾਰੇ ਅਖਬਾਰ ਅਤੇ ਟੀ ਵੀ ਨਿਊਜ ਚੈਨਲਾਂ ਦੇ ਨਾਂ ਜਾਣਦਾ ਹਾਂ ਇਹਨਾਂ ਵਿੱਚੋਂ ਕੁਝ ਪ੍ਰਮੁੱਖ ਅਖਬਾਰਾਂ ਦੇ ਨਾਂ ਇਸ ਪ੍ਰਕਾਰ ਹਨ ਅਜੀਤ ਜਗਬਾਣੀ ਚੜ੍ਹਦੀ ਕਲਾ ਦੇਸ਼ ਸੇਵਕ ਸੱਚ ਕਹੂੰ ਅਕਾਲੀ ਪੱਤ੍ਰਕਾ ਪੰਜਾਬੀ ਟ੍ਰਿਬਿਊਨ ਪੰਜਾਬੀ ਜਾਗਰਨ ਪੰਜਾਬ ਕੇਸਰੀ ਦੈਨਿਕ ਟਰਬਿਊਨ ਦੈਨਿਕ ਜਾਗਰਨ ਜਨ ਸਪਤਾਹ ਇੰਡੀਅਨ ਐਕਸਪ੍ਰੈਸ ਹਿੰਦੁਸਤਾਨ ਟਾਈਮਸ ਦਾ ਟਰਬਿਊਨ ਆਦਿ ਇਸ ਤੋਂ ਇਲਾਵਾ ਮੈਨੂੰ ਬਹੁਤ ਸਾਰੇ ਟੀ ਵੀ ਨਿਊਜ ਚੈਨਲ ਬਾਰੇ ਵੀ ਜਾਣਦਾ ਹਾਂ ਇਹਨਾਂ ਵਿੱਚੋਂ ਕੁਝ ਪ੍ਰਮੁੱਖ ਟੀ ਵੀ ਨਿਊਜ ਚੈਨਲ ਇਸ ਪ੍ਰਕਾਰ ਹਨ ਆਜ ਤੱਕ ਜੀ ਨਿਊਜ਼ ਨਿਊਜ਼ ਏਟੀਨ ਸਟਾਰ ਨਿਊਜ਼ ਪੀ ਟੀ ਸੀ ਨਿਊਜ਼ ਡੀ ਡੀ ਟੀ ਵੀ ਇੰਡੀਆ ਟੂਡੇ ਬੀ ਵੀ ਸੀ ਨਿਊਜ਼ ਭਾਰਤ ਨਿਊਜ਼ ਸੁਦਰਸ਼ਨ ਨਿਊਜ਼ ਇਹਨਾਂ ਅਖਬਾਰਾਂ ਅਤੇ ਨਿਊਜ ਚੈਨਲਾਂ ਵਿੱਚੋਂ ਮੈਨੂੰ ਜੋ ਪਸੰਦ ਹਨ ਉਸ ਬਾਰੇ ਮੈਂ ਆਪਣੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਅਖਬਾਰਾਂ ਵਿੱਚੋਂ ਮੈਨੂੰ ਅਜੀਤ ਪੰਜਾਬ ਕੇਸਰੀ ਅਤੇ ਦਾ ਟਰਬਿਊਨ ਅਖਬਾਰ ਬਥੇਰੇ ਪਸੰਦ ਹਨ ਕਿਉਂਕਿ ਇਹ ਮੈਨੂੰ ਜਿੱਥੇ ਅਲੱਗ ਅਲੱਗ ਭਾਸ਼ਾਵਾਂ ਦਾ ਗਿਆਨ ਦਿੰਦੇ ਹਨ ਉੱਥੇ ਇਹਨਾਂ ਅਖਬਾਰਾਂ ਦੀ ਭਰੋਸੇਯੋਗਤਾ ਹੋਰਾਂ ਅਖਬਾਰਾਂ ਨਾਲੋਂ ਬਥੇਰੇ ਲੱਗਦੀ ਹੈ ਟੀ ਵੀ ਨਿਊਜ ਚੈਨਲ ਵਿੱਚੋਂ ਮੈਨੂੰ ਆਜ ਤੱਕ ਪੀ ਟੀ ਸੀ ਨਿਊਜ਼ ਔਰ ਬੀ ਬੀ ਸੀ ਨਿਊਜ਼ ਬਥੇਰੇ ਪਸੰਦ ਹਨ ਕਿਉਂਕਿ ਜਿੱਥੇ ਮੈਨੂੰ ਅੱਜ ਤੱਕ ਪੂਰੇ ਦੇਸ਼ ਦੀਆਂ ਖਬਰਾਂ ਬਾਰੇ ਜਾਣਕਾਰੀ ਦਿੰਦਾ ਹੈ ਉੱਥੇ ਪੀ ਟੀ ਸੀ ਨਿਊਜ਼ ਮੈਨੂੰ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਬਾਰੇ ਅਤੇ ਪਰਮਾ ਪੰਜਾਬ ਵਿੱਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਾ ਹੈ ਬੀ ਬੀ ਸੀ ਨਿਊਜ਼ ਮੈਨੂੰ ਪੂਰੇ ਦੇਸ਼ ਵਿਦੇਸ਼ ਦੀਆਂ ਖਬਰਾਂ ਬਾਰੇ ਜਾਣਕਾਰੀ ਦਿੰਦਾ ਹੈ